ਪੇਂਡੂ ਖੇਤਰ ਵਿੱਚ ਕਿਸਾਨਾਂ ਨੂੰ ਵਿੱਤੀ ਪੈਸੇ ਦਾ ਵੀ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਬੈਂਕ ਉਹਨਾਂ ਨੂੰ ਲੋਨ ਨਹੀਂ ਦਿੰਦੇ ਕਿਉਂਕਿ ਪਿਛਲੇ ਪੈਸੇ ਉਹਦੇ ਫਸਲ ਖਰਾਬ ਹੋਣ ਨਾਲ ਚੁੱਕਾ ਨਹੀਂ ਹੁੰਦੇ ਵਾਪਸ ਨਹੀਂ ਹੁੰਦੇ ਅਤੇ ਫਸਲ ਪੱਕਣ 'ਤੇ ਮੌਸਮ ਵਿੱਚ ਵੀ ਤਬਦੀਲੀ ਆਈ ਜਾਂ ਬੇਮੌਸਮਾਂ ਮੀਂਹ ਪੈ ਪੈ ਜਾਂਦਾ ਅਤੇ ਸਾਰੀ ਫਸਲ ਖਰਾਬ ਹੋ ਜਾਂਦੀ ਆ ਅਤੇ ਉਹਨਾਂ ਨੂੰ ਸਿਖਲਾਈ ਵੀ ਕੋਈ ਦਿੱਤੀ ਨਹੀਂ ਜਾਂਦੀ ਅਤੇ ਫਸਲ ਬੀਜਣ ਦੇ ਸਮੇਂ ਕੋਈ ਖਾਦਾਂ ਨਹੀਂ ਸਮੇਂ ਸਿਰ ਮਿਲਦੀਆਂ ਅਤੇ ਬੀਜ ਨਹੀਂ ਮਿਲਦੇ ਬੀਜ ਜੇ ਮਿਲਦੇ ਆ ਡੁਪਲੀਕੇਟ ਮਿਲਦੇ ਆ ਅਤੇ ਜਿਸ ਨਾਲ ਕਿਸਾਨ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਕਰਜ਼ੇ ਦੇ ਬੋਝ ਥੱਲੇ ਦੱਬ ਜਾਂਦਾ ਹੈ ਅਤੇ ਕਈ ਕਿਸਾਨ ਆਤਮਹੱਤਿਆ ਵੀ ਕਰ ਲੈਂਦੇ ਆ ਪੈਸੇ ਦੇ ਕਰਜ਼ੇ ਨਾਲ਼